ਹਾਂ ਪਿੰਡਾਂ ਦੇ ਲੋਕ ਬੜੇ ਖੁਸ਼ ਰਹਿੰਦੇ ਨੇ ਪਿੰਡਾਂ ਦੇ ਲੋਕ ਜਿਹੜੇ ਨੇ ਬੱਚਿਆਂ ਨਾਲ ਬੜੇ ਖੁਸ਼ ਰਹਿੰਦੇ ਨੇ ਸਿਆਣਿਆਂ ਨਾਲ ਬੜੇ ਖੁਸ਼ ਰਹਿੰਦੇ ਨੇ ਕਹਾਵਤਾਂ ਸੁਣਾਉਂਦੇ ਰਹਿੰਦੇ ਨੇ ਚੰਗੀਆਂ ਬਾਤਾਂ ਪਾਉਂਦੇ ਰਹਿੰਦੇ ਨੇ ਬੜਾ ਮਨ ਖੁਸ਼ ਰਹਿੰਦਾ ਹੈ ਕੋਈ ਕਾਹ ਕਹਾਣੀ ਸੁਣਾਓ ਦੱਸੋ ਨਿੱਕੀ ਜਿਹੀ ਕੁੜੀ ਪੁੱਛਦੀ ਹੈ ਪਈ ਕੋਈ ਕਹਾਵਤ ਸੁਣਾਓ ਨਾ ਸਣ ਸੁਣਾਓ ਬੋਲੋ ਨਾ ਨਿੱਕੀ ਜਿਹੀ ਕੁੜੀ ਅਤੇ ਲੈ ਪਰਾਂਦਾ ਤੁਰੀ ਹੈਂਅ ਉਹ ਤੁਹਾਡੀਆਂ ਕਹਾਣੀਆਂ ਸੁਣਨੇ ਵਾਸਤੇ ਬੈਠੀ ਦੀ ਹੈ ਸੁਣਾਓ ਉਹਨਾਂ ਨੂੰ ਮੁਹਾਵਰਾ ਹੀ ਕੋਈ ਸੁਣਾ ਦਿਓ ਹਾਂ ਕਹਿੰਦੇ ਨਾ ਪੱਲੇ ਨੀ ਧੇਲਾ ਤੇ ਕਰਦੇ ਮੇਲਾ ਮੇਲਾ ਹੈਂਅ ਬੱਚੇ ਉਹਦੇ 'ਚ ਵੀ ਖੁਸ਼ ਹੋ ਜਾਂਦੇ ਨੇ